ਇੱਕ ਜਨਵਰੀ ਇੱਕ ਨੌ ਨੌ ਸੱਤ ਦੋ ਫਰਵਰੀ ਦੋ ਜੀਰੋ ਜੀਰੋ ਸੱਤ ਦੋ ਜਨਵਰੀ ਦੋ ਜੀਰੋ ਜੀਰੋ ਇੱਕ ਤਿੰਨ ਮਾਰਚ ਦੋ ਜੀਰੋ ਜੀਰੋ ਦੋ ਪੰਜ ਜੂਨ ਇੱਕ ਨੌ ਨੌ ਜੀਰੋ